ਭੰਗੜੇ ਦੇ ਕੁਛ ਆਮ ਸਟੈਪ ਝੂਮਰ ਧਮਾਲ ਲੁੱਡੀ ਸੰਮੀ ਸਿਆਲਕੋਟ ਸਾਪਸ ਖੁੰਡੇ ਮਿਰਜ਼ਾ ਆਦਿ ਹਨ ਇਹ ਪੰਜਾਬੀ ਸੱਭਿਆਚਾਰ ਵਿੱਚ ਬਹੁਤ ਮਹੱਤਵ ਰੱਖਦੇ ਹਨ ਅਤੇ ਇਹਦੇ ਤੋਂ ਬਿਨਾ ਪੰਜਾਬੀ ਸੱਭਿਆਚਾਰ ਨੂੰ ਪੂਰਾ ਨਹੀਂ ਮੰਨਿਆ ਜਾਂਦਾ ਅਤੇ ਇਹ ਵਿਆਹ ਸ਼ਾਦੀ ਅਤੇ ਤਿਉਹਾਰਾਂ ਦੇ ਵਿੱਚ ਇਹਦੇ ਤੋਂ ਬਿਨਾ ਤਿਉਹਾਰ ਅਧੂਰੇ ਹਨ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਪੰਜਾਬੀ ਸੱਭਿਆਚਾਰ ਦੇ ਵਿੱਚ